ਹਾਂ ਮੇਰਾ ਨਾਮ ਹਰੀਸ਼ ਸ਼ਰਮਾ ਹੈ ਮੇਰੇ ਕੋਲ ਪੁਰਾਣੀਆਂ ਫੋਟੋਆਂ ਹੋਰ ਜ਼ਿਆਦਾ ਪੁਰਾਣੀਆਂ ਫੋਟੋਆਂ ਹਨ ਜੋ ਕਿ ਇੱਕ ਫੋਲਡਰ ਵਿੱਚ ਪਾ ਕੇ ਰੱਖੀਆਂ ਹੋਈਆਂ ਹਨ ਅਤੇ ਮੈਂ ਉਹਨਾਂ ਨੂੰ ਬਹੁਤ ਜ਼ਿਆਦਾ ਪਸੰਦ ਕਰਦਾ ਹਾਂ ਉਹਨਾਂ ਨੂੰ ਹਰ ਵਕਤ ਜਦੋਂ ਕੋਈ ਪੁਰਾਣੀਆਂ ਨਿਸ਼ਾਨੀਆਂ ਦੇਖਣੀਆਂ ਹੋਣ ਤਾਂ ਮੈਂ ਉਹਨਾਂ ਦੀ ਵਰਤੋਂ ਕਰਕੇ ਉਹਨਾਂ ਨੂੰ ਦੇਖਦਾ ਹਾਂ ਅਤੇ ਪੁਰਾਣੀਆਂ ਯਾਦਾਂ ਨੂੰ ਤਾਜਾ ਕਰਦਾ ਹਾਂ ਅਤੇ ਪੁਰਾਣੀਆਂ ਅਤੇ ਨਵੀਆਂ ਫੋਟੋਆਂ ਵਿੱਚ ਬਹੁਤ ਜ਼ਿਆਦਾ ਅੰਤਰ ਹੈ ਪੁਰਾਣੀਆਂ ਫੋਟੋਆਂ ਸਾਨੂੰ ਬਹੁਤ ਕੁਝ ਯਾਦ ਦੁਆਉਂਦੀਆਂ ਹਨ ਅਸੀਂ ਕਿਵੇਂ ਖੇਡਦੇ ਸੀ ਕਿਵੇਂ ਰਹਿੰਦੇ ਸੀ ਰਹਿਣੀ ਬਹਿਣੀ ਉੱਠਣੀ ਕੱਪੜੇ ਪਾਉਣੇ ਅਲੱਗ ਅਲੱਗ ਤਰ੍ਹਾਂ ਦੇ ਸਾਨੂੰ ਯਾਦਾਂ ਦਵਾਉਂਦੀਆਂ ਹਨ ਨਵੀਆਂ ਫੋਟੋਆਂ ਅੱਜ ਕੱਲ ਚੱਲ ਤੇ ਪਈਆਂ ਹਨ ਪਰ ਅੱਜ ਕੱਲ ਹਰੇ ਕੋਲ ਹਰੇ ਕੋਲ ਮੋਬਾਇਲ ਹੋਣ ਕਰਕੇ ਹਰੇਕ ਕੋਲ ਬਹੁਤ ਜ਼ਿਆਦਾ ਫੋਟੋਆਂ ਹੁੰਦੀਆਂ ਹਨ ਅਤੇ ਬਹੁਤ ਜ਼ਿਆਦਾ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਹਨ ਕਿਉਂ ਮੋਇਲਾਂ ਵਿੱਚ ਰਹਿੰਦੀਆਂ ਨੇ ਅਤੇ ਪੁਰਾਣੀਆਂ ਫੋਟੋਆਂ ਜੋ ਕਿ ਆਪਣੀ ਐਲਬਮ ਵਿੱਚ ਰਹਿੰਦੀਆਂ ਹਨ ਉਹਨਾਂ ਨੂੰ ਜਦ ਵੀ ਦੇਖਦੇ ਹਾਂ ਅਤੇ ਮਨ ਭਰ ਆਉਂਦਾ ਹੈ ਬਹੁਤ ਖੁਸ਼ ਦੇ ਨਾਲ ਉਹਨਾਂ ਨੂੰ ਯਾਦ ਕਰਦੇ ਹਾਂ ਦੇਖਦੇ ਹਾਂ ਅਸੀਂ ਪੁਰਾਣੇ ਸਮਿਆਂ ਵਿੱਚ ਕਿਵੇਂ ਰਹਿੰਦੇ ਸੀ ਕਿਵੇਂ ਦਾ ਜੀਵਨ ਬਤੀਤ ਕਰਦੇ ਸੀ ਕਿਵੇਂ ਦੇ ਕੱਪੜੇ ਪਾਉਂਦੇ ਸੀ ਕੀ ਕਰਦੇ ਸੀ